ਹਾਂਜੀ ਅੱਜ ਕੱਲ੍ਹ ਜਿਵੇਂ ਕਿ ਪਤਾ ਆਪਾਂ ਨੂੰ ਵੀ ਜ਼ਮੀਨ ਖਰੀਦਣਾ ਬਹੁਤ ਸੌਖਾ ਅਤੇ ਵੇਚਣਾ ਉਸ ਤੋਂ ਵੀ ਔਖਾ ਕੰਮ ਹੈ ਉਹਦੇ ਕਾਗਜ਼ ਪੱਤਰ ਬਣਾਉਣਾ ਉਹਦੇ ਸਾਰੇ ਕਾਨੂੰਨੀ ਕਾਰਵਾਈ ਕਰਨਾ ਮੈਂ ਗੱਲ ਕਰਾਂ ਤਾਂ ਮੈਂ ਇੱਕ ਜ਼ਮੀਨ ਖਰੀਦੀ ਸੀਗੀ ਜੋ ਕਿ ਛੇ ਬਿਸਵੇ ਸੀ ਜਿਸਦਾ ਰੇਟ ਬਾਰ੍ਹਾਂ ਲੱਖ ਰੁਪਇਆ ਸੀਗਾ ਪਰ ਉਸਦੇ ਜੋ ਕਾਗਜ਼ ਦੀ ਕਾਰਵਾਈ ਸੀਗੀ ਉਸ ਦੇ ਵਿੱਚ ਸਾਨੂੰ ਬਹੁਤ ਟਾਈਮ ਲੱਗਿਆ ਬਣਾਉਣ ਦੇ ਵਿੱਚ ਸਾਨੂੰ ਕਚਹਿਰੀਆਂ ਵਿੱਚ ਜਾ ਜਾ ਕੇ ਕਿਤੇ ਕਿੱਥੇ ਕਦੇ ਕੁਛ ਕਦੇ ਕੀ ਬਣਾਉਣਾ ਪੈਂਦਾ ਜਿਹਦੇ ਕਿ ਐੱਨ ਓ ਸੀ ਸਾਡੇ ਹੋ ਰਹੀ ਸੀਗੀ ਐੱਨ ਓ ਸੀ ਹੋਣ ਤੋਂ ਬਾਅਦ ਹੀ ਜੋ ਜ਼ਮੀਨ ਆ ਸਾਡੇ ਨਾਮ ਹੋਣੀ ਸੀ ਪਰ ਐੱਨ ਓ ਸੀ ਨਹੀਂ ਹੋ ਰਹੀ ਸੀ ਜੇ ਕਿਤੇ ਜਾਂਦੇ ਤਾਂ ਕੋਈ ਉਹ ਕਹਿੰਦਾ ਸੀ ਇੰਨੇ ਪੈਸੇ ਲੱਗਣਗੇ ਇੰਨੇ ਪੈਸੇ ਲੱਗਣਗੇ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ ਸੀ ਤੇ ਇਸਦੇ ਵਿੱਚ ਹੀ ਸਾਨੂੰ ਬਹੁਤ ਦਿੱਕਤ ਆਈ ਕਦੇ ਕਿਸੇ ਕਚਹਿਰੀ ਜਾਂਦੇ ਉਹ ਸਾਨੂੰ ਕਿਤੇ ਹੋਰ ਪਾਸੇ ਭੇਜ ਦਿੰਦਾ ਅਤੇ ਕਿਸੇ ਹੋਰ ਪਾਸੇ ਭੇਜ ਦਿੰਦਾ ਜਿਸ ਵਿੱਚ ਸਾਨੂੰ ਜੋ ਜ਼ਮੀਨ ਆਪਣੇ ਨਾਮ ਕਰਵਾਉਣ ਦੇ ਵਿੱਚ ਬਹੁਤ ਦਿੱਕਤ ਆਈ ਅਤੇ ਗੱਲ ਕਰਾਂ ਜੇ ਕਾਨੂੰਨ ਦੀ ਕਾਨੂੰਨ ਇਸਦੇ ਵਿੱਚ ਕੁਛ ਨਹੀਂ ਉਹ ਸਿਰਫ ਰਿਸ਼ਵਤ ਭਾਲਦਾ ਜੇ ਰਿਸ਼ਵਤ ਮਿਲ ਜਾਂਦੀ ਹੈ ਤਾਂ ਟਾਈਮ ਟੂ ਟਾਈਮ ਕੰਮ ਕਰ ਦਿੰਦੇ ਹਾਂ ਪਰ ਅਸੀਂ ਰਿਸ਼ਵਤ ਦੇ ਖਿਲਾਫ ਹਾਂ ਅਤੇ ਸਾਨੂੰ ਉਹਨਾਂ ਨੇ ਰਿਸ਼ਵਤ ਦ ਦੱਸਿਆ ਵੀ ਹਾਂ ਸਾਨੂੰ ਇੰਨੇ ਪੈਸੇ ਦਿਉ ਅਸੀਂ ਐਵੇਂ ਕੰਮ ਐਵੇਂ ਹੋਵੇਗਾ ਐਵੇਂ ਹੋਵੇਗਾ ਪਰ ਅਸੀਂ ਰਿਸ਼ਵਤ ਦੇਣ ਤੋਂ ਮਨਾ ਕਰਤਾ ਜਿਸ ਕਰਕੇ ਸਾਡੇ ਕੰਮ ਨੂੰ ਟਾਈਮ ਬਹੁਤ ਜ਼ਿਆਦਾ ਲੱਗਿਆ ਪਰ ਅਸੀਂ ਕੰਮ ਕਰਵਾਇਆ ਅਸੀਂ ਜੇ ਕੋਈ ਕੰਮ ਕਰਵਾਉਣ ਜਾਂਦੇ ਕਾਨੂੰਨੀ ਕੰਮ ਤਾਂ ਉਹ ਕਿਤੇ ਹੋਰ ਤੋਂ ਹੋਰ ਅੱਗੇ ਸਾਨੂੰ ਦੱਸ ਦਿੰਦੇ ਵੀ ਇੱਧਰ ਜਾਓ ਇੱਧਰ ਜਾਓ ਇੱਧਰ ਜਾਓ ਅਤੇ ਜਿਸ ਕਰਕੇ ਸਾਨੂੰ ਬਹੁਤ ਦਿੱਕਤ ਆਈ ਜੋ ਕਿ ਅਸੀਂ ਜ਼ਮੀਨ ਆਪਣੇ ਨਾਮ ਕਰਵਾਈ ਸੀਗੀ ਉਹਨੂੰ ਇਸੀ ਟੈਮ ਇਸ ਕਰਕੇ ਸਾਨੂੰ ਬਹੁਤ ਟਾਈਮ ਲੱਗ ਗਿਆ ਉਹਨੂੰ ਆਪਣੇ ਨਾਮ ਕਰਵਾਉਣ ਦੇ ਵਿੱਚ